ਸਤਿ ਸ਼੍ਰੀ ਅਕਾਲ ਜੀ ਮੈਂ ਸਰ ਇਹ ਗੱਲ ਕਹਿ ਰਿਹਾ ਸੀ ਲੋਂਗੀ ਸਰ ਬੋਲ ਰਹੇ ਹੋ ਹਾਂਜੀ ਸਰ ਐਕਚੁਅਲ ਤਾਂ ਮੈਂ ਹਾਲੇ ਦਿੱਲੀ ਸ਼ਿਫ਼ਟ ਹੋਇਆ ਕਪੂਰਥਲੇ ਅਤੇ ਮੇਰੇ ਬਰਦਰ ਨੇ ਨੰਬਰ ਦਿੱਤਾ ਸੀ ਤੁਹਾਡਾ ਅਤੇ ਮੈਂ

ਹਾਂਜੀ ਅਤੇ ਹਾਂਜੀ ਮੈਂ ਉਹਦਾ ਬਹਦਰ ਛੋਟਾ ਬਰਦਰ ਬੋਲ ਰਿਹਾ ਅਤੇ ਭਾਅ ਜੀ ਮੈਂ ਤੁਹਾਡੇ ਗੱਲ ਪਤਾ ਕਰਨੀ ਸੀ ਮੈਂ ਆਪਣੇ ਨਿਆਣੇ ਲਗਾਉਣੇ ਸੀ ਸਕੂਲ 'ਤੇ ਮੈਨੂੰ ਕਪੂਰਥਲੇ ਕੋਈ ਵਧੀਆ ਸਕੂਲ ਦੱਸ ਸਕਦੇ ਕੋਈ ਜਿੱਥੇ ਮਤਲਬ ਫੀਸ ਵੀ ਠੀਕ ਹੋਵੇ

ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਭ ਤੋਂ ਵਧੀਆ ਸਕੂਲ ਕਿਹੜਾ ਹੈ ਇਹਨਾਂ ਚਾਰਾਂ ਤੋਂ ਅੱਛਾ ਜੀ ਠੀਕ ਹੈ ਸਰ ਠੀਕ ਹੈ ਜੀ ਅਤੇ ਮੈਂ ਤਾਂ ਆਪਣਾ ਮੈਂ ਤਾਂ ਸਰ ਆਪਣੇ ਮੁੰਡੇ ਅਤੇ ਕੁੜੀ ਨੂੰ ਆਫਸਰ ਬਣਾਉਣਾ ਆਰਮੀ ਅਫਸਰ ਅਤੇ ਉੱਥੇ ਕਿਆ ਠੀਕ ਹੈ ਸਰ ਅੱਛਾ ਬੋਰਡਿੰਗ ਸਕੂਲ ਹੈ ਅੱਛਾ ਜੀ ਅਤੇ ਸਰ ਇੱਥੇ ਕੋਈ ਐਂ ਐਂਟਰਸ ਹੁੰਦਾ ਵੈਸੇ ਕਿ ਡਰੈਕਟ ਐਡਮੀਸ਼ਨ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਅਤੇ ਤੁਹਾਨੂੰ ਮੈਂ ਮਿਲ ਸਕਦਾ ਸੀ ਕਪੂਰਥਲੇ ਆ ਕੇ ਤੁਸੀਂ ਮੇਰੇ ਨਾਲ ਚੱਲ ਪਾਉਂਗੇ ਸਕੂਲ ਜਾਂਦੇ ਜਾਂਦੇ ਅੱਛਾ ਜੀ ਥੋੜ੍ਹੀ ਯਾਰੀ ਦੋਸਤੀ ਪੈਜੂਗੀ ਨਾ ਅਤੇ ਆਪਾਂ ਥੋੜ੍ਹਾ ਦਿੱਲੀ ਦੇ ਆਏ ਹੋਏ ਆ ਫਿਰ ਇੱਥੇ

ਸਰ ਸਿਕਸ ਕਲਾਸ 'ਤੇ ਕਰਨਾ ਪਹਿਲਾਂ ਮੇਰਾ ਮੁੰਡਾ ਅਤੇ ਕੁੜੀ ਮੁੰਡਾ ਪੰਜਵੀਂ ਕਲਾਸ 'ਚ ਕੁੜੀ ਛੇਵੀਂ ਕਲਾਸ 'ਚ ਪਹਿਲਾਂ ਦਿੱਲੀ ਪਬਲਿਕ ਸਕੂਲ ਦੇ ਪੜ੍ਹ ਕੇ ਆਏ ਹੋਏ ਆ ਨਹੀਂ ਸਰ ਠੀਕ ਹੈ ਸਰ

ਨਹੀਂ ਸਰ ਸਕੂਲਿੰਗ ਤਾਂ ਪਿੱਛੇ ਵਧੀ ਹੋਈ ਹੈ ਡੀਪੀ ਸਕੂਲ ਨਾਮ ਸੁਣਿਆਂ ਤੁਸੀ ਦਿੱਲੀ ਦੇ ਅੱਛਾ ਅੱਛਾ ਜੀ ਅੱਛਾ ਚਲੋ ਕੋਈ ਨਹੀਂ ਜੀ ਫਿਰ ਆਪਾਂ ਮਿਲਦੇ ਐ ਮੈਂ ਤੁਹਾਡੇ ਕੋਲ ਆਵਾਂਗਾ ਯੈੱਸ ਠੀਕ ਹੈ ਸਰ ਠੀਕ ਹੈ ਸਰ ਕੋਈ ਠੀਕ ਹੈ ਸਰ ਠੀਕ ਹੈ ਸਰ ਕੋਈ ਚੱਕਰ ਨਹੀਂ ਠੀਕ ਧੰਨਵਾਦ ਜੀ ਓਕੇ ਓ